ਸਤਿ ਸ਼੍ਰੀ ਅਕਾਲ ਜੀ ਪਿਛਲੇ ਕੁਝ ਸਾਲਾਂ ਦੇ ਵਿੱਚ ਭਾਰਤ ਦੇ ਬੈਕਿੰਗ ਸੈਕਟਰ ਨੇ ਬੜੀ ਹੀ ਤਰੱਕੀ ਦਿਖਾਈ ਹੈ ਟੈਕਨੋਲੋਜੀ ਦੇ ਕਾਰਨ ਬੈਂਗਿੰਗ ਸੈਕਟਰ ਨੂੰ ਬੜਾ ਹੀ ਵਧੀਆ ਪ੍ਰਭਾਵ ਪਿਆ ਹੈ ਅਤੇ ਇਸ ਦੇ ਕਾਰਨ ਸਾਡਾ ਭਾਰਤ ਦਾ ਬੈਂਕਿੰਗ ਸੈਕਟਰ ਪੂਰੇ ਵਿਸ਼ਵ ਦੇ ਵਿੱਚ ਜਾਣਿਆ ਜਾ ਰਿਹਾ ਅਤੇ ਲੋਕ ਇਸ ਦੀ ਤਰੀਫ਼ ਕਰਦੇ ਹਨ ਅੱਜ ਕੱਲ੍ਹ ਲੋਕੀ ਬੈਂਕਿੰਗ ਐਪਸ ਦੀ ਵਰਤੋਂ ਕਰਦੇ ਹਨ ਜਿਸ ਦੇ ਨਾਲ ਲੋਕਾਂ ਨੂੰ ਬੈਂਕ ਦੇ ਕੰਮ ਬੜੇ ਹੀ ਆਸਾਨੀ ਨਾਲ ਕਰਵਾਏ ਜਾ ਸਕਦੇ ਆ ਲੋਕੀ ਅੱਜ ਕੱਲ੍ਹ ਆਪ ਬੈਂਕ ਜਾਣਾ ਪਸੰਦ ਨਹੀਂ ਕਰਦੇ ਅਤੇ ਸਾਰੇ ਦੇ ਸਾਰੇ ਰੋਜ਼ ਮੱਰਾ ਦੇ ਕੰਮ ਬੈਂਕਿੰਗ ਐਪਸ ਤੋਂ ਹੀ ਕਰ ਲੈਂਦੇ ਹਨ ਜਿਨ੍ਹਾਂ ਕਰਕੇ ਉਹਨਾਂ ਦੀ ਰੋਜ਼ ਮੱਰਾ ਦੀ ਜ਼ਿੰਦਗੀ 'ਤੇ ਕੋਈ ਵੀ ਜ਼ਿਆਦਾ ਅਸਰ ਨਹੀਂ ਪੈਂਦਾ ਅਤੇ ਉਹਨਾਂ ਦਾ ਸਮਾਂ ਬਰਬਾਦ ਨਹੀਂ ਹੁੰਦਾ ਉਹ ਲੰਬੀਆਂ ਬੈਂਕ ਦੀਆਂ ਲੰਬੀਆਂ ਲਾਈਨਾਂ ਤੋਂ ਬਚ ਗਏ ਹਨ ਅਤੇ ਉਹਨਾਂ ਦਾ ਕੰਮ ਬੜਾ ਹੀ ਸੁਖਾਲਾ ਹੋ ਜਾਂਦਾ ਹੈ ਮੈਂ ਆਪ ਵੀ ਆਪਣੇ ਬੈਂਕ ਪੰਜਾਬ ਨੈਸ਼ਨਲ ਬੈਂਕ ਦੀ ਬੈਂਕਿੰਗ ਐਪਸ ਦੀ ਵਰਤੋਂ ਦੇ ਨਾਲ ਹੀ ਆਪਣੇ ਕਈ ਕੰਮ ਨਿਬੇੜ ਦਿੰਦੀ ਹਾਂ ਜਿਨ੍ਹਾਂ ਕਰਕੇ ਮੇਰੇ ਸਾਰੇ ਕੰਮ ਬੜੇ ਹੀ ਜਲਦੀ ਹੋ ਜਾਂਦੇ ਹਨ ਅਤੇ ਈ ਬੈਂਕਿੰਗ ਦੇ ਨਾਲ ਮੈਨੂੰ ਬਹੁਤ ਹੀ ਜ਼ਿਆਦਾ ਸੁਵਿਧਾ ਜਨਕ ਤਰੀਕੇ ਨਾਲ ਮੇਰੇ ਸਾਰੇ ਦੇ ਸਾਰੇ ਕੰਮ ਹੋ ਜਾਂਦੇ ਹਨ